ਸਿੱਖਿਆ ਕਰਜ਼ਾ ਬਾਰੇ ਮੈਨੂੰ ਘੱਟ ਹੀ ਜਾਣਕਾਰੀ ਹੈ ਕਿਉਂਕਿ ਮੇਰੀ ਫੈਮਿਲੀ 'ਚ ਜਾਂ ਮੈਂ ਅੱਜ ਤੱਕ ਇਸਦਾ ਲਾਭ ਨਹੀਂ ਉਠਾਇਆ ਕਿਉਂਕਿ ਸਾਡੀ ਵਿੱਤੀ ਹਾਲਤ ਜੋ ਹੈ ਅਜੇ ਬਹੁਤ ਹੀ ਸਹੀ ਹੈ ਹਾਂ ਪਰ ਮੈਂ ਇਸਦੇ ਬਾਰੇ ਸੁਣਿਆ ਬਹੁਤ ਹੈ ਕਿ ਜਿਵੇਂ ਜੋ ਗਰੀਬ ਦਾ ਬੱਚਾ ਹੈ ਉਹਦੇ ਲਈ ਕਿਵੇਂ ਇਹ ਫਾਇਦੇਮੰਦ ਹੋ ਸਕਦਾ ਹੈ ਜਿਵੇਂ ਕੋਈ ਪੜ੍ਹਾ ਨਹੀਂ ਸਕਦਾ ਆਪਣੀ ਆਰਥਿਕ ਤੰਗੀ ਕਰਕੇ ਤਾਂ ਉਹ ਇਹ ਲੋਨ ਲੈ ਕੇ ਆਪਣੇ ਬੱਚੇ ਨੂੰ ਪੜ੍ਹਾ ਸਕਦੇ ਹਨ ਸਿੱਖਿਆ ਤੋਂ ਮਤਲਬ ਕੋਈ ਵੀ ਦੂਰ ਨਹੀਂ ਹੈ ਐਜੂਕੇਸ਼ਨ ਜੋ ਹੈ ਉਹ ਹਰੇਕ ਘਰ ਘਰ ਪਹੁੰਚਾਈ ਜਾ ਸਕਦੀ ਇਸ ਕਰਜ਼ੇ ਦੁਆਰਾ ਕੋਈ ਵੀ ਗਰੀਬ ਦਾ ਬੱਚਾ ਜੋ ਹੈ ਐਜੂਕੇਸ਼ਨ ਤੋਂ ਦੂਰ ਨਹੀਂ ਹੈ